ਜੋ ਮੇਰੇ ਮਨਪਸੰਦ ਗੀਤ ਹਨ ਸਭ ਤੋਂ ਪਹਿਲਾਂ ਮੇਰਾ ਗੀਤ ਸੀਗਾ ਸਾਡੇ ਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਇਸ ਗੀਤ ਨੂੰ ਮੈਂ ਬਹੁਤ ਜ਼ਿਆਦਾ ਸੁਣਿਆ ਉਸ ਤੋਂ ਬਾਅਦ ਫਤਹਿ ਗੀਤ ਰਣਜੀਤ ਬਾਵਾ ਜੀ ਦਾ ਗੀਤ ਆ ਇਹ ਇਸ ਗੀਤ ਨੂੰ ਮੈਂ ਬਹੁਤ ਜ਼ਿਆਦਾ ਸੁਣਿਆ ਇਸ ਤੋਂ ਬਿਨ ਇੱਕ ਜੁਝਾਰੂ ਖਾਲਸਾ ਗੀਤ ਇਹ ਵੀ ਗੀਤ ਸੁਣਦਾ ਇਸ ਤੋਂ ਬਿਨਾ ਇੱਕ ਕਵਾਲੀ ਸੀ ਨੁਸਰਤ ਫਤਹਿ ਅਲੀ ਖਾਨ ਸਾਹਿਬ ਦੀ ਉਹ ਸੀ ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਉਹ ਵਾਲਾ ਗੀਤ ਬਹੁਤ ਸੁਣਿਆ ਇੱਕ ਮਾਸਟਰ ਸਲੀਮ ਜੀ ਦਾ ਗੀਤ ਹੁੰਦਾ ਸੀਗਾ ਅੱਜ ਹੋਣਾ ਦੀਦਾਰ ਮਾਹੀ ਦਾ ਇਸ ਤਰੀ ਪ੍ਰਕਾਰ ਦੇ ਗੀਤ ਨੇ ਜਿਹੜੇ ਮੈਂ ਅਕਸਰ ਹੀ ਜਦੋਂ ਮੈਨੂੰ ਬੇਚੈਨੀ ਮਹਿਸੂਸ ਹੋਵੇ ਜਾਂ ਮੈਂ ਸਫਰ ਦੇ ਦੌਰਾਨ ਗੱਡੀ ਦੇ ਵਿੱਚ ਗੀਤ ਲਾ ਕੇ ਸੁਣਦਾ ਰਹਿੰਦਾ ਹਾਂ ਜਾਂ ਘਰ ਵੀ ਕਈ ਵਾਰ ਗੁਣ ਗੁਣਾਉਣ ਲੱਗ ਜਾਂਦਾ ਜਾਂ ਇਕੱਲਾ ਹੋਵਾ ਉਸ ਸਮੇਂ ਵੀ ਗਾਉਂਦਾ ਰਹਿੰਦਾ ਇਸ ਪ੍ਰਕਾਰ ਮੈਨੂੰ ਗਾਉਣਾ ਚੰਗਾ ਲੱਗਦਾ ਹੈ